ਭੰਗੜਾ ਪੰਜਾਬ ਦਾ ਇੱਕ ਪ੍ਰਮੁੱਖ ਲੋਕ ਨਾਚ ਹੈ ਜੋ ਕਿ ਪੰਜਾਬੀ ਸੱਭਿਆਚਾਰ ਵਿੱਚ ਲੋਕਾਂ ਨੂੰ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਬਣਾਇਆ ਗਿਆ ਹੈ ਇਹ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਪੰਜਾਬੀਆਂ ਵਿੱਚੋਂ ਪੰਜਾਬੀਅਤ ਅਤੇ ਭੰਗੜਾ ਦੋਨੋਂ ਹੀ ਅਲੱਗ ਨਹੀਂ ਕੀਤੇ ਜਾ ਸਕਦੇ ਭੰਗੜੇ ਦੇ ਪ੍ਰਦਰਸ਼ਨ ਲਈ ਜ਼ਿਆਦਾ ਤਕ ਰੰਗੀਨ ਕੱਪੜੇ ਵੱਖ ਰੰਗ ਦੇ ਪਹਿਨਾਵੇ ਦੀ ਜ਼ਰੂਰਤ ਹੁੰਦੀ ਹੈ ਇਸ ਵਿੱਚ ਪੰਜਾਬੀ ਕੁੜਤਾ ਚਾਦਰਾ ਅਤੇ ਫੁੱਲਾਂ ਵਾਲੀ ਜਾਕਟ ਗਲੇ ਵਿੱਚ ਕੈਂਠਾ ਜਾਂ ਮੋਤੀਆਂ ਦਾ ਹਾਰ ਹੁੰਦਾ ਹੈ ਇਸ ਤੋਂ ਇਲਾਵਾ ਸਿਰ ਉੱਪਰ ਪੱਗੜੀ ਦਾ ਹੋਣਾ ਵੀ ਬਹੁਤ ਹੀ ਜ਼ਰੂਰੀ ਹੁੰਦਾ ਹੈ ਭੰਗੜੇ ਲਈ ਪੱਗ ਤੇ ਵਿਸ਼ੇਸ਼ ਤਰ੍ਹਾਂ ਨਾਲ ਹੀ ਸਜਾਈ ਜਾਂਦੀ ਹੈ ਜਿਸ ਉੱਪਰ ਤੁਰਲਾ ਜੋ ਕਿ ਗਰਦਨ ਦੇ ਪਿੱਛੇ ਹੁੰਦਾ ਹੈ ਫਰਲਾ ਜੋ ਕਿ ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਤੋਂ ਮਾਵਾ ਲਗਾ ਕੇ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਪੱਗ ਉੱਪਰ ਰੰਗਦਾਰ ਪੱਟੀ ਬੰਨੀ ਜਾ ਸਕਦੀ ਹੈ ਭੰਗੜੇ ਦੀ ਟੀਮ ਵਿੱਚ ਹਰ ਇੱਕ ਦੇ ਵੱਖਰੇ ਰੰਗ ਦੀ ਪੁਸ਼ਾਕ ਪਾਈ ਜਾਂਦੀ ਹੈ ਜਿਸ ਨਾਲ ਉਹ ਇੱਦਾਂ ਲੱਗਦਾ ਹੈ ਜਿਵੇਂ ਕਿ ਕੋਈ ਰੰਗ ਬਿਰੰਗੀ ਫੁੱਲਾਂ ਦੀ ਫੁਲਵਾੜੀ ਹੋਵੇ ਇਸ ਤੋਂ ਇਲਾਵਾ ਪਿੱਤਲ ਅਤੇ ਕੋਕਿਆਂ ਵਾਲਾ ਖੂੰਡਾ ਅਤੇ ਤਿੱਲੇ ਵਾਲੀ ਜੁੱਤੀ ਪਾਈ ਜਾਂਦੀ ਹੈ ਕਿਸੇ ਵੀ ਵਿਆਹ ਸ਼ਾਦੀ ਤਿਉਹਾਰ ਜਿਵੇਂ ਕਿ ਵਿਸਾਖੀ ਜਿਸ ਵਿੱਚ ਕਿ ਫ਼ਸਲ ਕੱਟੀ ਜਾਂਦੀ ਹੈ ਖੁਸ਼ੀ ਦੇ ਮਾਹੌਲ ਜਿਵੇਂ ਕਿ ਵਿਆਹ ਵਾਲੇ ਦਿਨ ਬੱਚੇ ਜਵਾਨ ਭੰਗੜਾ ਪਾ ਕੇ ਆਪਣੀ ਖੁਸ਼ੀ ਮਨਾਉਂਦੇ ਹਨ ਅੱਜ ਕੱਲ੍ਹ ਤਾਂ ਵਿਦੇਸ਼ਾਂ ਵਿੱਚ ਵੀ ਭੰਗੜੇ ਦੀ ਬਹੁਤ ਚਰਚਾ ਹੈ ਜਿੱਥੇ ਜਿੱਥੇ ਪੰਜਾਬੀ ਵਸਦੇ ਹਨ ਉੱਥੇ ਉੱਥੇ ਭੰਗੜਾ ਆਪਣੇ ਸੱਭਿਆਚਾਰ ਉੱਥੇ ਦੇ ਸੱਭਿਆਚਾਰ ਨਾਲ ਰਲਾ ਦਿੱਤਾ ਹੈ ਭੰਗੜੇ ਦੇ ਕੁਝ ਹੋਰ ਪ੍ਰਕਾਰ ਵੀ ਹਨ ਜਿਵੇਂ ਕਿ ਜੁਗਨੀ ਝੂਮਰ ਕਲਹਿਰੀਆ ਟੱਪਾ ਧਮਾਲ ਲੁੱਡੀ ਮਲਵਈ ਗਿੱਧਾ ਇਹ ਵੀ ਭੰਗੜੇ ਦੇ ਪ੍ਰਚਲਿਤ ਰੂਪ ਹਨ ਇਸ ਵਿੱਚ ਸੱਪ ਕਾਟੋ ਬਖਸੂ ਚਿਮਟੇ ਦੀ ਵਰਤੋਂ ਕਰਕੇ ਭੰਗੜੇ ਨੇ ਬੋਲੀਆਂ ਨਾਲ ਰਲਾ ਕੇ ਹੋਰ ਸੋਹਣਾ ਕਰ ਦਿੱਤਾ ਗਿਆ ਹੈ ਭੰਗੜੇ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਲਈ ਇਸਦੀ ਕਾਲਜਾਂ ਸਕੂਲਾਂ ਵਿੱਚ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਜਿਸ ਨਾਲ ਕਿ ਹੋਰ ਸਟੇਟਾਂ ਤੋਂ ਆਏ ਬੱਚਿਆਂ ਨੂੰ ਵੀ ਭੰਗੜੇ ਦੀ ਪੂਰੀ ਸਖ ਸਿੱਖਿਆ ਮਿਲਦੀ ਹੈ ਤਾਂ ਕਿ ਇਹ ਭੰਗੜਾ ਪੂਰੇ ਭਾਰਤ ਵਿੱਚ ਫੈਲ ਜਾਵੇ ਅਤੇ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਤਾਂ ਇਸ ਨੂੰ ਅਲੱਗ ਅਲੱਗ ਦੇਸ਼ਾਂ ਵਿੱਚ ਫੈਲਾ ਹੀ ਦਿੱਤਾ ਹੈ ਅਤੇ ਇਨ ਇਸ ਨੂੰ ਉਹਨਾਂ ਦੇ ਸੱਭਿਆਚਾਰ ਨਾਲ ਮੇਲ ਖਵਾ ਦਿੱਤਾ ਹੈ